ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਪੰਜਾਬ ਦੇ ਜ਼ਿਆਦਾਤਰ ਲੋਕ ਖੇਤੀਬਾੜੀ 'ਤੇ ਨਿਰਭਰ ਕਰਦੇ ਹਨ ਇੱਥੇ ਜ਼ਿਆਦਾਤਰ ਖੇਤੀਬਾੜੀ ਕੀਤੀ ਜਾਂਦੀ ਹੈ ਖੇਤੀਬਾੜੀ ਦਾ ਵਿਕਾਸ ਹਰੀ ਕ੍ਰਾਂਤੀ ਦੇ ਨਾਲ਼ ਹੋਇਆ ਹੈ ਹਰੀ ਕ੍ਰਾਂਤੀ ਦੇ ਆਉਣ ਨਾਲ਼ ਹੀ ਖੇਤੀਬਾੜੀ ਦਾ ਵੱਧ ਤੋਂ ਵੱਧ ਵਿਕਾਸ ਹੋਇਆ ਹੈ ਖੇਤੀਬਾੜੀ ਹੁਣ ਜ਼ਿਆਦਾ ਕੀਤੀ ਜਾਣ ਲੱਗੀ ਹੈ ਹਰੀ ਕ੍ਰਾਂਤੀ ਦੇ ਨਿਰਮਾਣ ਨਾਲ਼ ਹੀ ਖੇਤੀ ਵਿੱਚ ਵਾਧਾ ਹੋਇਆ ਹੈ ਖੇਤੀਬਾੜੀ ਵਿੱਚ ਵਾਧਾ ਹੋਣ ਨਾਲ਼ ਵਪਾਰ ਵਿੱਚ ਵੀ ਵਾਧਾ ਹੋਇਆ ਹੈ ਜਿਸ ਕਾਰਨ ਲੋਕਾਂ ਦੀ ਲੋਕਾਂ ਦੀ ਆਰਥਿਕਤਾ ਵੀ ਵੱਧ ਗਈ ਹੈ ਲੋਕਾਂ ਦੀ ਰੋਜ਼ੀ ਰੋਟੀ ਵੀ ਵਧੀਆ ਹੋ ਗਈ ਹੈ ਖੇਤੀਬਾੜੀ ਇੱਕ ਬਹੁਤ ਵਧੀਆ ਕਿੱਤਾ ਹੈ